ਹਾਂ ਮੈਨੂੰ ਲੱਗਦਾ ਹੈ ਕਿ ਭੰਗੜਾ ਐਰੋਬਿਕ ਮੁਕਾਬਲੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਅਤੇ ਜਸ਼ਨ ਵਿੱਚ ਯੋਗਦਾਨ ਪਾਉਂਦੇ ਹਨ ਕਿਉਂਕਿ ਭੰਗੜਾ ਲੋਕ ਨਾਚ ਦੀ ਰੀਡ ਢੋਲ ਨੂੰ ਸਿ ਸਿੱਖਿਆ ਗਿਆ ਹੈ ਕਿਉਂਕਿ ਨਾਚ ਨੱਚਣ ਸਮੇਂ ਢੋਲੀ ਨੇ ਹੀ ਸਾਰੇ ਨਾਚੀਆਂ ਨੂੰ ਇੱਕ ਲੈਅ ਅਤੇ ਤਾਲ ਅਨੁਕੂਲ ਨਚਾਉਣਾ ਹੁੰਦਾ ਹੈ ਭੰਗੜਾ ਨੱਚਣਾ ਆਰੰਭ ਕਰਨ ਸਮੇਂ ਢੋਲੀ ਤਾਲ ਵਜਾਉਂਦਾ ਹੈ ਜਿਸ ਦੀ ਲੈਅ ਵਿੱਚ ਇੱਕ ਸੁਰ ਹੁੰਦੇ ਭੰਗੜੇ ਭੀੜ ਵਿੱਚ ਪ੍ਰਵੇਸ਼ਨ ਕਰਦੇ ਹਨ ਪਹਿਲਾਂ ਹੋਲੀ ਅਤੇ ਫਿਰ ਸਹਿਜੇ ਸਹਿਜੇ ਗੀਤ ਨਾਲ ਨੱਚਣ ਲੱਗਦੇ ਹਨ ਪੰਜਾਬੀ ਗਭਰੂ ਜਿੱਥੇ ਵੀ ਵੱਸਦੇ ਹਨ ਦੁਨੀਆਂ ਦੀ ਜਿਹੜੇ ਵੀ ਥਾਂ 'ਤੇ ਵੱਸਦੇ ਹਨ ਇੱਦਾਂ ਨਹੀਂ ਹੋ ਸਕਦਾ ਕਿ ਉਹ ਭੰਗੜਾ ਨਾ ਪਾਉਂਦੇ ਹੋਣ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਭੰਗੜ ਭੰਗੜੇ ਦਾ ਸੰਬੰਧ ਤਾਲ ਅਤੇ ਢੋਲ ਨਾਲ ਹੈ ਅਜੋਕੇ ਲੋਕ ਨਾਚ ਭੰਗੜੇ ਵਿੱਚ ਸਿਆਲਟੀ ਭੰਗੜੇ ਦੀਆਂ ਕੁਝ ਸਥਾਨਕ ਤਾਲਾਂ ਸ਼ਾਮਲ ਕਰ ਗਈਆਂ ਹਨ ਅਤੇ ਲੁੱਡੀ ਜਿਵੇਂ ਕਿ ਝੂਮਰ ਇਹੋ ਜਿਹੇ ਲੋਕ ਨਾਚ ਸਾਡੇ ਪੰਜਾਬ ਦੇ ਸੱਭਿਆਚਾਰ ਵਿੱਚ ਕਾਫ਼ੀ ਯੋਗਦਾਨ ਪਾਉਂਦੇ ਹਨ ਇਹਨਾਂ ਯੋਗਦਾਨਾਂ ਦੇ ਹੋਣ ਕਰਕੇ ਹੀ ਸਾਡਾ ਪੰਜਾਬ ਬਾਕੀ ਦੇਸ਼ਾਂ ਵਿਦੇਸ਼ਾਂ ਨਾਲੋਂ ਅੱਗੇ ਵੱਧ ਰਿਹਾ ਹੈ ਇਹ ਹੀ ਕਹਿਣਾ ਸਹੀ ਹੈ ਕਿ ਭੰ ਐਰੋਬਿਕ ਮੁਕਾਬਲੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਅਤੇ ਜਸ਼ਨ ਵਿੱਚ ਯੋਗਦਾਨ ਪਾਉਂਦਾ ਹੀ ਸਾਡਾ ਭੰਗੜਾ ਹੈ ਪੰਜਾਬ ਦੇ ਜਿੱਥੇ ਵੀ ਵੱਸਦੇ ਲੋਕ ਨੋਚ ਲੋਕ ਨਾਚ ਕਰਦੇ ਹਨ ਉਹ ਸਾਡਾ ਭੰਗੜੇ ਨੂੰ ਹੀ ਜ਼ਿਆਦਾਤਰ ਪਸੰਦ ਕਰਦੇ ਹਨ ਪੰਜਾਬੀਆਂ ਦਾ ਜਿੱਥੇ ਵੀ ਵੱਸਣਾ ਹੈ ਉਹ ਲੋਕ ਨਾਚ ਨੂੰ ਕਦੇ ਵੀ ਨਹੀਂ ਭੁੱਲਦੇ ਹਨ